ਪੰਜਾਬੀ ਭਾਸ਼ਾ ਦੀ ਵਰਤੋਂ ਮੈਂ ਕੁਛ ਉਦਾਹਰਣਾਂ ਬਣਾ ਕੇ ਸਮਝਾ ਸਕਦਾ ਕਿੱਦਾਂ ਕੀਤੀ ਜਾਂਦੀਆਂ ਹਨ ਜਿੱਦਾਂ ਮੈਂ ਕੋਈ ਦੁਕਾਨ 'ਤੇ ਕੁਛ ਸੌਦਾ ਲੈਣ ਗਿਆ ਅਤੇ ਉਹ ਕਨਵਰਜੇਸ਼ਨ ਨੂੰ ਉਹ ਬੋਲ ਚਾਲ ਇੱਦਾਂ ਹੋਵੇਗੀ ਕਿ ਮੈਂ ਜਾਵਾਂਗਾ ਅਤੇ ਉਹਨਾਂ ਨੂੰ ਸਮਾਨ ਦੱਸਾਂਗਾ ਕਿ ਅੰਡੇ ਚਾਹੀਦੇ ਹਨ ਖੰਡ ਚਾਹੀਦੀ ਹੈ ਆਟਾ ਚਾਹੀਦਾ ਹੈ ਚਾਵਲ ਚਾਹੀਦੇ ਹਨ ਇੰਨੇ ਕਿਲੋ ਚਾਹੀਦੇ ਹਨ ਉਹ ਫਿਰ ਪਾ ਕੇ ਦੇਣਗੇ ਫਿਰ ਉਹ ਪੁੱਛਣਗੇ ਕਿੰਨੇ ਪੈਸੇ ਅਸੀਂ ਪੁੱਛਾਂਗੇ ਕਿੰਨੇ ਪੈਸੇ ਬਣੇ ਉਹ ਦੱਸਣਗੇ ਕਿੰਨੇ ਪੈਸੇ ਬਣੇ ਅਸੀਂ ਫਿਰ ਪੈਸੇ ਦਵਾਂਗੇ ਇੱਦਾਂ ਬਸ ਸਧਾਰਨ ਹੀ ਚੱਲਦੀ ਹੈ ਜਿੱਦਾਂ ਕੋਈ ਹੋਰ ਜਗ੍ਹਾ ਚਲੇ ਜਾਓ ਰੈਸਟੋਰੈਂਟ ਜਾਈਦਾ ਹੈ ਤਾਂ ਖਾਣਾ ਔਡਰ ਕਰੀਦਾ ਹੈ ਉਹ ਮੈਨਿਓ ਲਿਆ ਕੇ ਦਿੰਦੇ ਹਨ ਅਤੇ ਅਸੀਂ ਔਡਰ ਕਰੀਦਾ ਹੈ ਮਤਲਬ ਇੱਦਾਂ ਮਲਟੀਪਲ ਕਾਫ਼ੀ ਉਦਾਹਰਣਾਂ ਹਨ ਉਦਾਹਰਣਾਂ ਦੇ ਨਾਲ ਹੀ ਦੱਸੀ ਜਾ ਸਕਦੀ ਹੈ ਮਤਲਬ ਟੂਰਿਸਟ ਹੋਣ ਉਹ ਆਉਂਦੇ ਹਨ ਜਾਂ ਅਸੀਂ ਟੂਰਿਸਟ ਬਣ ਕੇ ਕਿਤੇ ਜਾਂਦੇ ਹਨ